ਹੈਲੋ ਸਰ ਮੈਂ ਮਨੀਸ਼ਾ ਕੁਮਾਰੀ ਬੋਲ ਰਹੀ ਹਾਂ ਕੀ ਕੀ ਤੁਸੀਂ ਉਬਰ ਐਪ ਤੋਂ ਬੋਲ ਰਹੇ ਹੋ ਹਾਂਜੀ ਮੈਂ ਨਾ ਕਿਤੇ ਨੇੜੇ ਮਤਲਵ ਜਾਣਾ ਸੀਗਾ ਐਡਜੈਂਟਲੀ ਜਾਣਾ ਸੀਗਾ ਅਤੇ ਮੈਨੂੰ ਕੈਬ ਚਾਹੀਦੀ ਸੀ ਕੋਈ ਗੱਡੀ ਤੁਹਾਡੇ ਕੋਲ ਫ੍ਰੀ ਹੋਵੇ ਜਿੱਦਾਂ ਕਿ ਇੰਡੀਗੋ ਵਗੈਰਾ ਹੈ ਨਾ ਫ੍ਰੀ ਹੋਵੇ ਅਤੇ ਮੈਂ ਜਾਣਾ ਹੈ ਮਤਲਵ ਜ਼ਿਆਦਾ ਨਹੀਂ ਮਤਲ ਥੋੜ੍ਹੇ ਦੇਰ ਦੂਰੇ ਹੈ ਜ਼ਿਆਦਾ ਦੂਰ ਨਹੀਂ ਹੈ ਨਾ ਅਤੇ ਤੁਹਾਡੇ ਕੋਲ ਫ੍ਰੀ ਹੋਵੇ ਤਾਂ ਤੁਸੀਂ ਭੇਜ ਸਕਦੇ ਹੋ ਅਤੇ ਕਿਉਂਕਿ ਫੇਰ ਮੈਨੂੰ ਫਿਰ ਜਿਆ ਖੜ੍ਹੇ ਪੈਰ ਜਾਣਾ ਪੈ ਰਿਹਾ ਨਾ ਮੈਨੂੰ ਕੀ ਆ ਤੁਹਾਡੇ ਤੋਂ ਜੇ ਨਹੀਂ ਵੀ ਫ੍ਰੀ ਹੈ ਤਾਂ ਕੋਈ ਗੱਲ ਨਹੀਂ ਤੁਸੀਂ ਔਟੋ ਹੈ ਤਾਂ ਔਟੋ ਨੂੰ ਭੇਜ ਦਿਓ ਮੈਂ ਉਹਦੇ ਨਾਲ ਵੀ ਕੰਮ ਚੱਲ ਜੂਗਾ ਮਤਲਬ ਜ਼ਿਆਦਾ ਦੂਰ ਨਹੀਂ ਜਾਣਾ ਨੇੜੇ ਹੀ ਆ ਹੈ ਨਾ ਬਲਾਚੋਰ ਹੈ ਜਾਣਾ ਮੈਂ ਐਕਚੁਅਲ 'ਚ ਹਾਂਜੀ ਤਾਂ ਕਰਕੇ ਤੁਸੀਂ ਇੱਦਾਂ ਕਰਿਓ ਕਿ ਭੇਜ ਦਿਓ ਹੈ ਨਾ ਹਾਂਜੀ ਠੀਕ